ਫੋਟੋਆਂ ਨੂੰ ਸੰਪਾਦਿਤ ਕਰਨਾ ਫੋਟੋਗਰਾਫੀ ਦਾ ਇੱਕ ਦਿਲਚਸਪ ਹਿੱਸਾ ਹੈ ਜੋ ਤੁਹਾਨੂੰ ਚਿੱਤਰ ਨੂੰ ਸੁਧਾਰਨ ਅਤੇ ਤੁਹਾਡੇ ਸਿਡਜਾ ਸਿਰਜਨਾਤਮਕ ਦ੍ਰਿਸ਼ਟੀਕੋਣ ਨੂੰ ਜੀਵਨ ਵਿੱਚ ਲਿਆਉਣ ਦੀ ਆਗਿਆ ਦਿੰਦਾ ਹੈ ਮੇਰੇ ਲਈ ਇਹ ਪ੍ਰਕਿਰਿਆ ਵਿੱਚ ਕੁਛ ਮੁੱਖ ਕਦਮ ਅਤੇ ਸਾਧਨ ਸ਼ਾਮਿਲ ਹਨ ਜੋ ਮੇਰੀਆਂ ਤਸਵੀਰਾਂ ਨੂੰ ਵਧਾਉਣ ਵਿੱਚ ਮੇਰੀ ਮਦਦ ਕਰਦੇ ਹਨ ਮੈਂ ਮੁੱਖ ਤੌਰ 'ਤੇ ਸੰਪਾਦਨ ਲਈ ਅਡੋਬ ਲਾਈਟਰੂਮ ਅਤੇ ਫੋਟੋਸ਼ਾਪ 'ਤੇ ਨਿਰਭਰ ਕਰਦਾ ਹਾਂ ਕਿਉਂਕਿ ਦੋਵੇਂ ਸਟੀਕ ਸਮਾ ਸਮਾਯੋਜਨ ਲਈ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੀ ਪੇਸ਼ਕਸ ਕਰਦੇ ਹਨ ਲਾਈਟ ਰੂਮ ਓਮ ਐਕਸਪੋਜਰ ਰੰਗ ਗ੍ਰੇਡੀਐਟ ਅਤੇ ਹਾਈਲਾਈਟਸ ਅਤੇ ਸੈਡੋ ਨੂੰ ਐਡਜਸਟ ਕਰਨ ਲਈ ਸ਼ਾਨਦਾਰ ਹਨ ਇਹ ਇਸ ਦੇ ਗੈਰ ਵਿਸ਼ ਵਿਨਾਸ਼ਕਾਰੀ ਸੰਪਾਦਨ ਅਤੇ ਸ਼ਕਤੀਸ਼ੀਲਾਂ ਭਰਿਸ਼ ਪ੍ਰੀਸੈਟ ਸਮ ਸਮਰਥਾਵਾਂ ਦੇ ਕਾਰਨ ਫੋਟੋਆਂ ਦੇ ਵੱਡੇ ਬੈਚਾਂ ਦਾ ਪ੍ਰਬੰਧ ਕਰਨ ਲਈ ਸ ਸੰਪੂਰਨ ਹਨ ਮੈਂ ਅਕਸਰ ਲਾਈਟ ਰੂਮ ਦੇ ਟੂਲਸ ਦੀ ਵਰਤੋਂ ਚਿੱਟੇ ਸੰਤੁਲਨ ਕੰਟਰਾਸਟ ਅਤੇ ਤਿੱਖਾਪਣ ਨੂੰ ਐਡਜਸਟ ਕਰਨ ਲਈ ਕਰਦਾ ਹਾਂ ਇਹ ਯਕੀਨੀ ਬਣਾਉਂਦਾ ਹਾਂ ਕਿ ਫੋਟੋ ਜੀਵਨ ਅਤੇ ਸੰਤੁਲਿਤ ਦਿਖਾਈ ਦੇਵੇ ਦੂਜੇ ਪਾਸੇ ਫੋਟੋਸ਼ਾਪ ਵਧੇਰੇ ਵਿਸਤ੍ਰਿਤ ਅਤੇ ਰਚਨਾਤਮਕ ਸੰਪਰਦਾਵਾਂ ਲਈ ਮੇਰੀ ਜਾਣ ਪਛਾਣ ਹੈ ਮੈਂ ਅਕਸਰ ਇਸ ਨੂੰ ਆਪਣੇ ਅਣਚਾਹੇ ਵਸਤੂਆਂ ਨੂੰ ਹਟਾਉਣ ਚਮੜੀ ਨੂੰ ਮੁੜ ਛੂਹਣ ਟੈਕਸਚਰ ਨੂੰ ਵਧਾਉਣ ਅਤੇ ਲੇਅਰਾਂ ਨਾਲ ਕੰਮ ਕਰਨ ਵਰਗੇ ਕੰਮਾਂ ਲਈ ਵਰਤਦਾ ਹਾਂ ਫੋਟੋਸ਼ੋਪ ਦੀਆਂ ਉੱਨਤ ਵਿਸ਼ੇਸ਼ਤਾਵਾਂ ਜਿਵੇਂ ਕਿ ਕਲੋਨ ਸਟੈਂਪ ਅਤੇ ਹੀਲਿੰਗ ਬੁਰਸ਼ ਮੈਨੂੰ ਚਿੱਤਰ ਨੂੰ ਸਾਫ ਕਰਨ ਅਤੇ ਸੁਧਾਰਨ ਵਿੱਚ ਮਦਦ ਕਰਦੀਆਂ ਹਨ ਜਦੋਂ ਕਿ ਲੇਅਰ ਮਾਸਕ ਮੈਨੂੰ ਚੋਣਵੇਂ ਅਤੇ ਗੈਰ ਸ ਸਥਾਈ ਤਰੀਕੇ ਨਾਲ ਸਮਾਯੋਜਨ ਲਾਗੂ ਕਰਨ ਦੀ ਆਗਿਆ ਦਿੰਦੇ ਹਨ